ਪੰਜਾਬ ਦੀ ਅਰਥਵਿਵਸਥਾ ਭਾਰਤ ਦੇ ਦੂਜੇ ਖੇਤਰਾਂ ਨਾਲੋਂ ਬਹੁਤ ਵਧੀਆ ਹੈ ਕਿਉਂਕਿ ਪੰਜਾਬ ਵਿੱਚ ਇੰਡਸਟਰੀ ਬਹੁਤ ਹੈ ਇੱਥੇ ਲੋਕਾਂ ਕੋਲ ਪੈਸਾ ਵੀ ਬਹੁਤ ਹੈ ਲਗਾਉਣ ਵਾਸਤੇ ਪਰ ਸਰਕਾਰ ਜਿਹੜੀ ਹੈ ਪੰਜਾਬ ਨੂੰ ਜ਼ਿਆਦਾ ਏਡ ਨਹੀਂ ਦੇ ਰਹੀ ਜਿਸ ਕਰਕੇ ਪੰਜਾਬ ਰਾਜ ਪਿੱਛੇ ਚੱਲ ਰਿਹਾ ਹੈ ਪਰ ਪੰਜਾਬ ਦੇ ਕੋਲ ਬਹੁਤ ਹੀ ਵਧੀਆ ਸ਼ਖਸੀਅਤਾਂ ਨੇ ਬਹੁਤ ਹੀ ਵਧੀਆ ਕਾਰਖਾਨੇ ਨੇ ਇਹ ਹੌਜਰੀ ਦਾ ਗੜ੍ਹ ਹੈ ਅਤੇ ਸਭ ਤੋਂ ਵੱਧ ਜਿਹੜਾ ਹੈਗਾ ਇੰਡਸਟਰੀ ਆ ਉਹ ਲੁਧਿਆਣਾ ਦੇ ਵਿੱਚ ਹੈ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਪਰ ਸਰਕਾਰ ਇਹਨਾਂ ਇੰਡਸਟਰੀਆਂ ਨੂੰ ਫੰਡ ਨਹੀਂ ਦੇ ਰਹੀ ਇੰਨਾਂ ਇੱਦਾਂ ਇਹਨਾਂ ਨਾਲ ਧੱਕਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਇੱਥੇ ਜਲੰਧਰ ਦੇ ਵਿੱਚ ਜਿਹੜੀ ਹੈ ਕ੍ਰਿਕਟ ਦੇ ਨਾਲ ਸੰਬੰਧਿਤ ਖੇਡਾਂ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਹਾਕੀ ਫੁਟਬਾਲ ਬਣਾਏ ਜਾਂਦੇ ਹਨ ਪੰਜਾਬ ਬਹੁਤ ਹੀ ਵਧੀਆ ਪ੍ਰਦੇਸ਼ ਹੈ ਪਰ ਜੇ ਇਹਨਾਂ ਇਹਦੀ ਸਹਾਇਤਾ ਕੀਤੀ ਜਾਵੇ ਤਾਂ ਇਹ ਬਹੁਤ ਅੱਗੇ ਜਾ ਸਕਦਾ ਹੈ ਪਰ ਸਰਕਾਰ ਪੰਜਾਬ ਨੂੰ ਹਮੇਸ਼ਾਂ ਪਿੱਛੇ ਰੱਖਦੀ ਹੈ ਹੌਜਰੀ ਅਤੇ ਗਰਮ ਕੱਪੜਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੀ ਬਣਾਇਆ ਜਾ ਰਿਹਾ ਹੈ